ਨੌਂ ਅਕਤੂਬਰ ਦੋ ਹਜ਼ਾਰ ਬਾਈ ਦਸ ਨਵੰਬਰ ਉੱਨੀ ਸੌ ਕਿਆਸੀ ਤੇਰਾਂ ਜਨਵਰੀ ਦੋ ਹਜ਼ਾਰ ਪੰਜ ਚਾਰ ਮਾਰਚ ਦੋ ਹਜ਼ਾਰ ਸੱਤ ਅੱਠ ਜੂਨ ਦੋ ਹਜ਼ਾਰ ਪੰਦਰਾਂ